ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੌਣ ਬੋਲਦੇ ਹੋ ਅੱਛਾ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ

ਅੱਛਾ ਅੱਛਾ ਅਤੇ ਇੱਥੇ ਇੱਕ ਤਾਂ ਬੈਂਕ ਰੋਡ ਤੋਂ ਵੀ ਮਿਲ ਜਾਂਦੇ ਜੀ ਗਰਮ ਮਤਲਬ ਕੋਟੀਆਂ ਵਗੈਰਾ ਸਵਾਟਰ ਵਗੈਰਾ ਕੋਈ ਸ਼ਾਲ ਵਗੈਰਾ ਲੈਣੇ ਹੋਣ ਤਾਂ ਕੈਸਲ ਮਾਰਕੀਟ ਹੈਗੀ ਇੱਥੇ ਬੈਕ ਰੋਡ 'ਤੇ ਅਤੇ ਮੇਨ ਬਾਜ਼ਾਰ ਹੈਗਾ ਇੱਥੇ ਅਤੇ ਜੇ ਜ਼ਿਆਦਾ ਬਰਾਂਡ ਦੇ ਕੱਪੜੇ ਲੈਣੇ ਆ ਤਾਂ ਆਪਣਾ ਕੋਟਕਪੂਰਾ ਰੋਡ ਜਿਹੜੀ ਆ ਉੱਥੇ ਵੀ ਮਿਲ ਜਾਂਦੇ ਆ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਹੈਗੀਆਂ ਬਹੁਤ ਵਧੀਆ ਵਧੀਆ ਸ਼ੋਰੂਮ ਆ ਇੱਥੇ ਅਤੇ ਇੱਥੇ ਆਪਣੇ ਹੁਣ ਬਾਈਪਾਸ 'ਤੇ ਵੀ ਸ਼ੋਰੂਮ ਬਹੁਤ ਬਣ ਗਏ ਹੋਏ ਆ ਇੱਥੇ ਕੋਟਪੁਰਾ ਰੋਡ ਜਿਹੜਾ ਬਹਾਦਰ ਰੋਡ ਨੂੰ ਆਉਂਦਾ ਉੱਥੇ ਵੀ ਬਹੁਤ ਬਣੇ ਹੋਏ ਆ ਅਤੇ ਉਥੋਂ ਵੀ ਤੁਸੀਂ ਮਤਲਬ ਕਿ ਲੈ ਸਕਦੇ ਆ ਅਤੇ ਹਾਂਜੀ ਉਹ ਵੀ ਆਪਣੇ ਇੱਥੇ ਨਾ ਸਦਰ ਠਾਣਾ ਹੈਗਾ ਸੀ ਜੀ ਅਤੇ ਉਹਦੇ ਨਾਲ ਹੀ ਉਹ ਪਸ਼ਮਨ ਵਾਲੀ ਗਲੀ ਵੱਜਦੀ ਆ ਹਾਂਜੀ ਅਤੇ ਉਹਦੇ ਵਿੱਚ ਜਦੋਂ ਆਪਾਂ ਅੰਦਰ ਐਂਟਰੀ ਕਰਦੇ ਹਾਂ ਅਤੇ ਉਹ ਸਾਰੇ ਪਸ਼ੂਆਂ ਵਾਲੀ ਗਲੀ ਵੱਜਦੀ ਆ ਅਤੇ ਉੱਥੇ ਜ਼ਿਆਦਾ ਮਤਲਬ ਪਸ਼ਮਨ ਦੀ ਦੁਕਾਨਾਂ ਹੈਗੀਆਂ ਅਤੇ ਜ਼ਿਆਦਾਤਰ ਦੋ ਘਰ ਹੈਗੇ ਉਹ ਵਧੀਆ ਜੋ ਪਸ਼ਮਨ ਰੱਖਦੇ ਆ ਅਤੇ ਉਹਨਾਂ ਤੋਂ ਆਪਾਂ ਲੈ ਸਕਦੇ ਹਾਂ ਬਣੀਆਂ ਬਣਾਈਆਂ ਵੀ ਮਿਲ ਜਾਂਦੀਆਂ ਉਹਨਾਂ ਕੋਲੋਂ ਅਤੇ ਵਧੀਆ ਪਸ਼ਮਨ ਵੀ ਮਿਲ ਜਾਂਦੀ ਹੈ ਉਹ ਤਾਂ ਵੇਖਣਾ ਪੈਂਦਾ ਵੀ ਕਿਹੋ ਜਿਹਾ ਬੁਣਿਆ ਜੇ ਚੰਗਾ ਲੱਗੇ ਤਾਂ ਲੈ ਲਓ ਨਹੀਂ ਤਾਂ ਫਿਰ ਵੈਸੇ ਤਾਂ ਮੈਂ ਵੀ ਕੰਮ ਕਰਦੀ ਹਾਂ ਕੋਟੀਆਂ ਸਵੈਟਰਾਂ ਦਾ ਹਾਂਜੀ ਪਸ਼ਮ ਰਖੀ ਹੋਈ ਹੈ ਮੈਂ ਵੀ ਅਤੇ ਜੇ ਤੁਹਾਡਾ ਮਨ ਬਣੇ ਤਾਂ ਚਲੋ ਕੋਈ ਨਹੀਂ ਆਪਾਂ ਵੀ ਤੁਸੀਂ ਵੇਖ ਲਿਆ ਜੇ ਮੇਰੀਆਂ ਬੁਣੀਆਂ ਤੁਹਾਨੂੰ ਦਿਖਾ ਦਾਂਗੇ ਤੁਹਾਨੂੰ ਚੰਗੀਆਂ ਲਗੀਆਂ ਤਾਂ ਬਣਵਾ ਲਿਓ ਜੇ ਹਾਂ ਆਜੋ ਨਾਲੇ ਕੋਈ ਚਾਹ ਪਾਣੀ ਦੀ ਸੇਵਾ ਕਰਾਂਗੇ ਨਾਲੇ ਕੋਈ ਤੁਹਾਨੂੰ ਵਿਖਾ ਦਾਂਗੇ ਫਿਰ ਹਾਂ

ਹਾਂ ਹਮ ਹਮ ਹਾਂ ਕੋਈ ਗੱਲ ਨਹੀਂ ਉਹ ਤਾਂ ਜਿੱਥੇ ਜੇ ਕਿਸੇ ਨੂੰ ਚੰਗੀ ਲੱਗੇ ਚੀਜ਼ ਉੱਥੇ ਲੈਂਦਾ ਜੇ ਬਜ਼ਾਰੋਂ ਚੰਗੀ ਵੀ ਲੈ ਸਕਦੇ ਹੋ ਤੁਸੀਂ ਹਾਂਜੀ ਹਾਂ ਹਮ ਠੀਕ ਹੈ ਹਾਂ ਕੋਈ ਨਹੀਂ ਓਕੇ ਠੀਕ ਹੈ ਓਕੇ